ਪੰਜਾਬ ਦੇ ਸੱਭਿਆਚਾਰ ਵਿੱਚ ਧਰਮ ਦੀ ਭੂਮਿਕਾ ਬਹੁਤ ਜ਼ਿਆਦਾ ਹੈ ਸ਼ੁਰੂ ਤੋਂ ਹੀ ਧਰਮ ਅਤੇ ਸੱਭਿਆਚਾਰ ਨਾਲ ਨਾਲ ਚਲਦੇ ਆਏ ਹਨ ਧਰਮ ਸੱਭਿਆਚਾਰ ਨੂੰ ਬਚਾਉਣ ਦਾ ਇੱਕ ਬਹੁਤ ਵੱਡਾ ਕੰਮ ਨਿਭਾਉਂਦਾ ਹੈ ਜੇਕਰ ਅਸੀਂ ਦੇਖੀਏ ਕਿ ਲੋਕ ਪਹਿਰਾਵੇ ਲੋਕ ਗੀਤ ਤਾਂ ਧਰਮ ਉਹਨਾਂ ਨੂੰ ਬਚਾਉਣ 'ਚ ਬਹੁਤ ਇੱਕ ਵੱਡਾ ਭੂਮਿਕਾ ਨਿਭਾਉਂਦਾ ਆਇਆ ਹੈ ਜੇਕਰ ਅਸੀਂ ਕਿਸੇ ਵੀ ਧਰਮ ਨੂੰ ਦੇਖੀਏ ਤਾਂ ਉਹ ਸੱਭਿਆਚਾਰ ਨੂੰ ਬਹੁਤ ਪ੍ਰਮੋਟ ਕਰਦਾ ਹੈ